ਹੈਲੋ ਨਮਸਤੇ ਮੈਮ ਮੈਮ ਤੁਸੀਂ ਪਾਇਲ ਮੈਮ ਬੋਲ ਰਹੇ ਓ ਯੋਗਾ ਕਲਾਸਿਸ ਤੋਂ ਹਾਂਜੀ ਮੈਮ ਮੈਂ ਤੁਹਾਨੂੰ ਪੁੱਛਣਾ ਸੀ ਆਪਣੇ ਬੱਚਿਆਂ ਨੂੰ ਲਗਾਉਣਾ ਸੀ ਯੋਗਾ ਕਲਾਸਿਸ ਹਾਂਜੀ ਮੈਮ ਅਤੇ ਮੈਂ ਪੁੱਛਣਾ ਸੀ ਕਿ ਤੁਹਾਡੀ ਕੀ ਟਾਈਮਿੰਗ ਹੈ ਕੀ ਚਾਰਜਿਸ ਲੈਂਦੇ ਹੋ ਤੁਸੀਂ ਹਾਂਜੀ ਮੈਮ ਹਾਂਜੀ ਮੈਮ ਹਾਂਜੀ ਮੈਮ ਮੈਂ ਐਕਚੁਲੀ ਮੈਂ ਆਪਣੇ ਬੱਚਿਆਂ ਨੂੰ ਲਗਾਉਣਾ ਸੀ ਮੇਰੇ ਬੱਚੇ ਇੱਕ ਸੈਵੰਥ 'ਚ ਹੈ ਇੱਕ ਏਟਥ 'ਚ ਹੈ ਹਾਂਜੀ ਤਾਂ ਸੂਬਹਾ ਤਾਂ ਉਹ ਸਕੂਲ ਜਾਂਦੇ ਨੇ ਮੈਮ ਹਾਂਜੀ ਤਾਂ ਸਿਕਸ ਓ ਕਲੋਕ ਵਾਲੀ ਟਾਈਮਿੰਗ ਠੀਕ ਹੈ ਮੈਮ ਹਾਂਜੀ ਮੈਮ ਓ ਮੈਮ ਹਾਂਜੀ ਮੈਮ ਉਸ ਤੋਂ ਬਾਅਦ ਹੀ ਰੱਖਿਆ ਜਾਏਗਾ ਕਿਉਂਕਿ ਉਸ ਤੋਂ ਬਾਅਦ ਸਕੂਲ ਵੀ ਜਾਣਾ ਹੁੰਦਾ ਅਤੇ ਫੇਰ ਸ਼ਾਮ ਨੂੰ ਟਾਈਮ ਨਹੀਂ ਹੁੰਦਾ ਹਾਂਜੀ ਹਾਂਜੀ ਮੈਮ

ਹਾਂਜੀ ਮੈਮ ਹਾਂਜੀ ਮੈਮ ਹਾਂਜੀ ਮੈਮ ਉਹ ਤੁਸੀਂ ਪ੍ਰੋਪਰਲੀ ਮੈਨੂੰ ਤੁਸੀਂ ਦੱਸ ਦਿਓ ਮੈਂ ਤੁਹਾਨੂੰ ਇੱਕ ਵਾਰੀ ਵੈਸੇ ਹੀ ਮਿਲਣ ਆਵਾਂਗੀ ਅਤੇ ਦੇਖ ਵੀ ਲਵਾਂਗੀ ਬਈ ਕਿਸ ਤਰ੍ਹਾਂ ਤੁਹਾਡੀ ਕਲਾਸਿਸ ਲੱਗਦੀਆਂ ਨੇ ਅਤੇ ਹਾਂਜੀ ਤੁਸੀਂ ਕਿਸ ਤਰ੍ਹਾਂ ਗਾਈਡ ਕਰਦੇ ਹੋ ਬੱਚਿਆਂ ਨੂੰ ਅਤੇ ਮੈਂ ਦੇਖ ਲਵਾਂਗੀ ਅਤੇ ਤੁਸੀਂ ਮੈਨੂੰ ਪ੍ਰੋਪਰਲੀ ਦੱਸ ਦਿਓ ਹਾਂਜੀ ਮੈਮ ਹਾਂਜੀ ਮੈਮ ਹਾਂਜੀ ਮੈਮ

ਓਕੇ ਮੈਮ ਥੈਂਕ ਯੂ ਸੋ ਮਚ ਮੈਮ